ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾ ਹਾਂਜੀ ਸਰ ਹਾਂਜੀ ਹਾਂਜੀ ਹਾਂ ਕੈਬ ਬੁੱਕ ਕੀਤੀ ਸੀਗੀ ਸਰ ਆਪਣਾ ਤੁਸੀਂ ਇੱਥੇ ਆਪਣਾ ਜੋ ਚੁੰਗੀ ਵਾਲੇ ਬਾਜ਼ਾਰ 'ਚ ਆ ਜਾਓ ਇਸ ਟਾਈਮ ਕਿੱਥੇ ਬੋਲ ਰਹੇ ਹੋ ਤੁਸੀਂ ਆਪਣਾ ਤੁਸੀਂ ਇਸ ਤਰ੍ਹਾਂ ਕਰੋ ਨਾ ਆਪਣਾ ਐਲਫਾ ਵੰਨ ਦੇ ਲਾਗੇ ਆ ਜਾਓ ਅਤੇ ਉਹਦੇ ਸਾਹਮਣੇ ਜਿਹੜੀ ਪ੍ਰਤਾਪ ਨਗਰ ਨੂੰ ਸੜਕ ਮੁੜਦੀ ਆ ਨਾ ਹਾਂ ਉਹ ਤੋਂ ਸਿੱਧਾ ਤੁਸੀਂ ਆ ਜਾਓ ਅਤੇ ਉੱਥੇ ਆ ਕੇ ਉਹ ਸਾਹਮਣੇ ਚੁੰਗੀ ਵਾਲੇ ਬਾਜ਼ਾਰ 'ਚ ਆ ਜਾਓਗੇ ਅਤੇ ਉੱਥੋਂ ਆ ਕੇ ਮੈਂ ਫਿਰ ਮੈਂ ਤੁਹਾਨੂੰ ਕੋਲ ਕਰ ਦਾਂਗਾ ਜਾਂ ਤੁਸੀਂ ਮੈਨੂੰ ਕੋਲ ਕਰ ਦੇਣਾ ਅਤੇ ਮੈਂ ਆ ਕੇ ਤੁਹਾਨੂੰ ਉੱਥੋਂ ਦੀ ਬਾਹਰੋਂ ਪਿੱਕ ਕਰ ਲਾਂਗਾ ਹਾਂ ਚਲੋ ਇੱਦਾਂ ਕਰਦਾ ਮੈਂ ਲੋਕੇਸ਼ਨ ਹੀ ਤੁਹਾਨੂੰ ਸੈਂਡ ਕਰ ਦਿੰਦਾ ਵਾਂ ਓਕੇ ਸਰ ਠੀਕ ਆ ਠੀਕ ਆ ਓਕੇ ਸਰ ਸਤਿ ਸ਼੍ਰੀ ਅਕਾਲ